ਪੌਦੇ ਪੌਦਿਆਂ ਦਾ ਕੀ ਕਿਹਾ ਜਾਵੇ ਪੌਦਿਆਂ ਦਾ ਕੋਈ ਪਤਾ ਨਹੀਂ ਲੱਗਦਾ ਜ਼ਿਆਦਾ ਗਰਮੀ ਹੋਵੇ ਤਾਂ ਵੀ ਇਹ ਖਰਾਬ ਹੋ ਜਾਂਦੇ ਆ ਸਰਦੀ ਹੋਵੇ ਤਾਂ ਵੀ ਇਹ ਪੀਲੇ ਪੈ ਜਾਂਦੀ ਹੈ ਗਰਮੀ 'ਚ ਇਹ ਮੁਰਝਾ ਜਾਂਦੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਪਾਣੀ ਦੀ ਵਿਚਾਰਿਆਂ ਨੂੰ ਲੋੜ ਹੁੰਦੀ ਹੈ ਗਰਮੀ 'ਚ ਜਿੰਨਾ ਪਾਣੀ ਦਿੱਤਾ ਜਾਵੇ ਓਨਾ ਹੀ ਥੋੜ੍ਹਾ ਪੌਦਿਆਂ ਨੂੰ ਅਤੇ ਸਰਦੀ 'ਚ ਇਹ ਵਿਚਾਰੇ ਸਰਦੀ 'ਚ ਬਾਹਰ ਪਏ ਕੋਰੇ ਨਾਲ ਕੋਰਾ ਜੰਮ ਜਾਂਦਾ ਪੀਲੇ ਪੈ ਜਾਂਦੇ ਆ ਸਾਰੇ ਤਾਂ ਇਹਨਾਂ ਦੀ ਦੇਖ ਭਾਲ ਸਰਦੀ 'ਚ ਵੀ ਲੋੜ ਪੈਂਦੀ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਸੰਭਾਲਣਾ ਪੈਂਦਾ ਸਰਦੀ 'ਚ ਤਾਂ ਸਰਦੀ 'ਚ ਬਾਹਰ ਵੀ ਰੱਖੇ ਪੌਦੇ ਖਰਾਬ ਹੋ ਜਾਂਦੇ ਆ ਫਿਰ ਇਹਨਾਂ ਨੂੰ ਅੰਦਰ ਕਰਨਾ ਪੈਂਦਾ ਇਹਨਾਂ ਨੂੰ ਜ਼ਿਆਦਾ ਗਰਮੀ ਵੀ ਖਰਾਬ ਕਰਦੀ ਹੈ ਜ਼ਿਆਦਾ ਸਰਦੀ ਵੀ ਖਰਾਬ ਕਰਦੀ ਆ ਇਸ ਲਈ ਇਹਨਾਂ ਦੀ ਦੇਖਭਾਲ ਇਹਨਾਂ 'ਚ ਦਵਾਈਆਂ ਜੋ ਵੀ ਛਿੜਕਾਅ ਹੁੰਦਾ ਦਵਾਈਆਂ ਦਾ ਉਹਨਾਂ ਨੂੰ ਸਮੇਂ ਸਿਰ ਦੇਣਾ ਚਾਹੀਦਾ ਸਮੇਂ ਸਿਰ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਇਹਨਾ ਦੀ ਦੇਖਭਾਲ ਪੂਰੀ ਚਾਹੀਦੀ ਹੈ ਪੌਦਿਆਂ ਨੂੰ ਗਰਮੀ ਸਰਦੀ ਕਈ ਪੌਦੇ ਇਨਡੋਰ ਹੁੰਦੇ ਆ ਕਈ ਪੌਦੇ ਆਊਟਡੋਰ ਹੁੰਦੇ ਆ ਜਿਹੜੇ ਆਊਟਡੋਰ ਹੁੰਦੇ ਆ ਉਹ ਤਾਂ ਵਧੀਆ ਵੱਧ ਫੁੱਲ ਜਾਂਦੇ ਹੈ ਜਿਹੜੇ ਇਨਡੋਰ ਹੁੰਦੇ ਆ ਉਹ ਆਪਣੇ ਘਰਾਂ 'ਚ ਹੁੰਦੇ ਆ ਇਸ ਲਈ ਇਹਨਾਂ ਦੀ ਦੇਖਭਾਲ ਜ਼ਿਆਦਾ ਜ਼ਰੂਰੀ ਹੈ ਜਿੰਨੀ ਦੇਖਭਾਲ ਕੀਤੀ ਜਾਵੇ ਪੌਦਿਆਂ ਦੀ ਤਾਂ ਓਨੀ ਘੱਟ ਹੈ ਪੌਦੇ ਪੌਦਿਆਂ ਦੀਆਂ ਇੰਨੀਆਂ ਕੀਟਨਾਸ਼ਕ ਦਵਾਈਆਂ ਆਉਂਦੀਆਂ ਜੋ ਵੀ ਆਪਾਂ ਵਰਤਦੇ ਹਾਂ ਉਹ ਵੀ ਵਧੀਆ ਖਾਦ ਹੋਣੀ ਚਾਹੀਦੀ ਹੈ ਦੇਖ ਕੇ ਲੈਣੀ ਚਾਹੀਦੀ ਆਪਾਂ ਨੂੰ ਖਾਦ ਵਧੀਆ ਹੋਊਗੀ ਤਾਂ ਪੌਦੇ ਵਧੀਆ ਉਗਣਗੇ ਫਲ ਵਧੀਆ ਮਿਲੂਗਾ ਮੈਨੂੰ ਗੈਲਰੀ ਵਾਲੇ ਪੌਦੇ ਬਹੁਤ ਵਧੀਆ ਲੱਗਦੇ ਆਪਣੀ ਗੈਲਰੀ 'ਚ ਸਜਾਵਟ ਲਈ ਕਿੰਨੇ ਚੰਗੇ ਲੱਗਦੇ ਆ ਪੌਦੇ